ਘਰ ਵਿੱਚ ਜ਼ੁਕਾਮ ਦੇ ਇਲਾਜ ਵਾਸਤੇ ਜੋ ਕਿ ਘਰ ਦੇ ਵਿੱਚ ਆਪਾਂ ਇਸਤੇਮਾਲ ਕਰ ਸਕਦੇ ਹਾਂ ਜਿਵੇਂ ਕਿ ਦੋ ਗਲਾਸ ਗਰਮ ਪਾਣੀ ਵਿੱਚ ਅਦਰਕ ਧਨੀਆ ਤੁਲਸੀ ਦੇ ਪੱਤੇ ਮਿਲਾ ਕੇ ਪਾਓ ਉਸ ਨੂੰ ਪਾਣੀ ਨੂੰ ਉਬਾਲ ਕੇ ਪੀਣ ਦੇ ਨਾਲ ਜ਼ੁਕਾਮ ਤੋਂ ਕਾਫ਼ੀ ਰਾਹਤ ਮਿਲਦੀ ਹੈ ਇਸੇ ਤਰ੍ਹਾਂ ਇਕ ਗਲਾਸ ਪਾਣੀ ਲਓ ਸੁੱਕਾ ਅਦਰਕ ਅਜਵਾਇਣ ਕਾਲੀ ਮਿਰਚ ਕੜ੍ਹੀ ਪੱਤਾ ਦਾ ਕਾੜਾ ਬਣਾਓ ਉਹਦੇ ਨਾਲ ਆਪਣਾ ਅਨਮਿਊਨ ਸਿਸਟਮ ਕਾਫ਼ੀ ਜ਼ਿਆਦਾ ਵਧੀਆ ਰਹਿੰਦਾ ਅਤੇ ਅਤੇ ਤੀਜਾ ਨੁਕਤਾ ਜਿਵੇਂ ਕਿ ਆਪਾਂ ਗਰਮ ਪਾਣੀ ਦੀ ਭਾਫ਼ ਲੈਂਦੇ ਹਾਂ ਜਾਂ ਗਰਮ ਪਾਣੀ ਵਿੱਚ ਤੁਲਸੀ ਦੇ ਪੱਤੇ ਹਲਦੀ ਪਾਊਡਰ ਜੋ ਕਿ ਬੰਦ ਨੱਕ ਨੂੰ ਖੋਲਣ ਦਾ ਕੰਮ ਕਰਦਾ ਹੈ ਜਿਹਦੇ ਨਾਲ ਕਾਫ਼ੀ ਜ਼ਿਆਦਾ ਰਿਲੀਫ ਮਿਲਦਾ ਹੈ